ਖੁੱਲੇ ਪਾਣੀ 'ਚ ਬੰਦੇ ਨੇ ਜਿਵੇਂ ਸਾਡੇ ਨਹਿਰਾਂ ਨਹੂਰਾਂ 'ਚ ਜੇ ਤੈਰਾਕੀ ਕਰਦੇ ਹੈ ਉੱਥੇ ਤਾਂ ਇਹ ਇਹੀ ਸਿੱਖਿਆ ਵੀ ਜਾਨੀ ਕਿ ਬੰਦਾ ਟਿਊਬ ਜ਼ਰੂਰ ਰੱਖੇ ਨਾਲ ਸੇਫਟੀ ਖਾਤਰ